ਹੈਲੋ ਓਲਾ ਕੈਬ ਤੋਂ ਬੋਲ ਰਹੇ ਹੋ ਮੈਂ ਸਰ ਦਸ ਮਿੰਟ ਪਹਿਲਾਂ ਔਡਰ ਬੁੱਕ ਕੀਤਾ ਸੀਗਾ ਅਤੇ ਮੈਂ ਏਅਰਪੋਰਟ ਨੂੰ ਆਪਣੀ ਫਲਾਈਟ ਫੜਨੀ ਹੈ ਇਸ ਕਰਕੇ ਮੈਂ ਫੋਨ ਕਰ ਰਿਹਾ ਹਾਂ ਕਿਉਂਕਿ ਡਰਾਈਵਰ ਮੇਰਾ ਫੋਨ ਨਹੀਂ ਚੁੱਕ ਰਿਹਾ ਕਿਉਂਕਿ ਮੈਂ ਟਾਈਮ ਸਿਰ ਪਹੁੰਚਣਾ ਚਾਹੁੰਦਾ ਹਾਂ ਵੀ ਮੇਰੀ ਫਲਾਈਟ ਮਿਸ ਨਾ ਹੋ ਜਾਵੇ ਅਤੇ ਤੁਸੀਂ ਮੈਨੂੰ ਦੱਸੋ ਤੁਹਾਡਾ ਡਰਾਈਵਰ ਆ ਰਿਹਾ ਹੈ ਕਿ ਨਹੀਂ ਆ ਰਿਹਾ ਤਾਂ ਕਿ ਫਿਰ ਮੈਨੂੰ ਕਨਫਰਮੇਸ਼ਨ ਹੋ ਜਾਵੇ ਤਾਂ ਕਿ ਮੈਂ ਜੇ ਤੁਹਾਡਾ ਡਰਾਈਵਰ ਨਹੀਂ ਆ ਰਿਹਾ ਤਾਂ ਮੈਂ ਤੁਹਾਡਾ ਔਡਰ ਕੈਂਸਲ ਕਰਕੇ ਦੂਸਰਾ ਔਡਰ ਬੁੱਕ ਕਰਾ ਤਾਂ ਕਿ ਮੈਂ ਆਪਣੇ ਟਾਈਮ ਸਿਰ ਪਹੁੰਚਗਾ ਕਿਉਂਕਿ ਮੈਂ ਉੱਥੇ ਨਹੀਂ ਪਹੁੰਚਿਆ ਤਾਂ ਮੇਰੀ ਫਲਾਈਟ ਮਿਸ ਹੋ ਜਾਵੇਗੀ ਇਸ ਤੋਂ ਪਹਿਲੇ ਕੀ ਤੁਸੀਂ ਮੈਨੂੰ ਕਨਫਰਮੇਸ਼ਨ ਮੈਸੇਜ ਭੇਜ ਦਿਓ ਕਿ ਤੁਹਾਡਾ ਡਰਾਈਵਰ ਮੇਰੇ ਕੋਲ ਟਾਈਮ ਸਿਰ ਪਹੁੰਚੇਗਾ ਕਿ ਨਹੀਂ ਪਹੁੰਚੇਗਾ ਨਹੀਂ ਤਾਂ ਫਿਰ ਮੈਂ ਆਪਣਾ ਅਰੇਂਜਮੈਂਟ ਖੁਦ ਖੁਦ ਕਰ ਲਵਾਂ ਤਾਂ ਕਿ ਫਿਰ ਮੈਂ ਤੁਹਾਡੀ ਕੰਪਲੇਂਟ ਕਰ ਸਕਾਂ ਕਿਉਂਕਿ ਮੈਂ ਲੇਟ ਹੋ ਗਿਆ ਤਾਂ ਮੇਰਾ ਬਹੁਤ ਨੁਕਸਾਨ ਹੋ ਜਾਵੇਗਾ ਟਾਈਮ ਸਿਰ ਏਅਰਪੋਰਟ ਨਹੀਂ ਪਹੁੰਚ ਪਾਵਾਂਗਾ ਧੰਨਵਾਦ ਜੀ